ਹੈਲੋ ਉੱਬਰ ਮੈਂ ਕੈਬ ਬੁੱਕ ਕੀਤੀ ਸੀ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਰੱਦ ਕੀਤੀ ਜਾਵੇ ਕਿਉਂਕਿ ਮੈਥੋਂ ਉਹਦੇ ਵਿੱਚ ਗਲਤ ਅਡਰੈਸ ਫਿੱਲ ਕੀਤਾ ਗਿਆ ਗੱਲ ਇਹ ਹੋਈ ਸੀ ਕਿ ਮੈਂ ਪੇਪਰ ਦੇਣ ਜਾਣਾ ਸੀ ਅਤੇ ਉਸ 'ਤੇ ਮੈਂ ਬਹੁਤ ਲੇਟ ਸੀਗੀ ਜਿਸ ਕਰਕੇ ਮੈਨੂੰ ਕਾਹਲੀ ਸੀ ਅਤੇ ਮੈਂ ਕੈਬ ਬੁੱਕ ਕਰ ਲਈ ਜਦੋਂ ਮੈਂ ਕੈਬ ਆ ਵਾਲੇ ਨੂੰ ਫੋਨ ਕੀਤਾ ਤਾਂ ਪਹਿਲਾਂ ਤਾਂ ਉਸਨੇ ਚੱਕਿਆ ਨਹੀਂ ਅਤੇ ਜਦੋਂ ਉਹਨੇ ਚੱਕਿਆ ਤਾਂ ਉਸਨੇ ਮੈਨੂੰ ਕਿਹਾ ਕਿ ਮੈਂ ਅਡਰੈਸ 'ਤੇ ਪਹੁੰਚ ਗਿਆ ਹਾਂ ਜਦੋਂ ਮੈਂ ਉੱਥੇ ਖੜ੍ਹੀ ਸੀ ਅਤੇ ਜਦੋਂ ਮੈਂ ਆਪਣੇ ਆਸੇ ਪਾਸੇ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਫਿਰ ਮੈਂ ਉਸਨੂੰ ਦੁਬਾਰਾ ਕਾਲ ਕੀਤੀ ਅਤੇ ਉਸਨੇ ਮੈਨੂੰ ਕਿਹਾ ਕਿ ਮੈਂ ਉਹੀ ਅਡਰੈਸ 'ਤੇ ਹਾਂ ਅਤੇ ਜਦੋਂ ਮੈਂ ਉਹਨੂੰ ਕਿਹਾ ਕਿ ਤੁਸੀਂ ਕਿਹੜੇ ਅਡਰੈਸ 'ਤੇ ਹੋ ਤਾਂ ਉਸਨੇ ਮੈਨੂੰ ਅਡਰੈਸ ਦੱਸਿਆ ਅਤੇ ਫਿਰ ਉਸ ਤੋਂ ਬਾਅਦ 'ਚ ਮੈਂ ਜਦੋਂ ਉਹਨੇ ਕਿਹਾ ਕਿ ਮੈਂ ਉਹੀ ਅਡਰੈਸ 'ਤੇ ਹਾਂ ਜਿਹੜਾ ਤੁਸੀਂ ਉਹਦੇ ਵਿੱਚ ਲਿਖਿਆ ਹੋਇਆ ਸੀ ਅਤੇ ਜਦੋਂ ਮੈਂ ਐਪ ਓਪਨ ਕਰਕੇ ਆਪਦਾ ਅਡਰੈਸ ਦੁਬਾਰਾ ਚੈੱਕ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਥੋਂ ਗਲਤੀ ਨਾਲ ਗਲਤ ਡਰੈਸ ਭਰਿਆ ਗਿਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਕਾਹਲੀ ਸੀ ਜਿਸ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਅਤੇ ਮੈਂ ਪੈਸੇ ਪਹਿਲਾਂ ਹੀ ਟ੍ਰਾਂਸਫਰ ਕਰ ਦਿੱਤੇ ਸੀਗੇ ਜਿਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਮੇਰੇ ਜਿਹੜੇ ਟਰਾਂਸਫਰ ਕੀਤੇ ਹੋਏ ਪੈਸੇ ਆ ਉਹ ਵਾਪਸ ਕੀਤੇ ਜਾਣ ਅਤੇ ਮੇਰੀ ਕੈਬ ਨੂੰ ਰੱਦ ਕੀਤਾ ਜਾਵੇ